ਹਾਂਜੀ ਮੈਂ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦਾ ਉਪਯੋਗ ਕੀਤਾ ਹੋਇਆ ਹੈ ਇਸ ਜਿਹੜੀ ਬਲੈਕ ਐਂਡ ਵਾਈਟ ਆਪਾਂ ਯੂਸ ਕਰਦੇ ਹਾਂ ਕਿਸੇ ਵੀ ਫੋਟੋ ਦੇ ਵਿੱਚ ਉਹ ਹਰੇਕ ਪੀੜ੍ਹੀ ਨੂੰ ਦਰਸਾਉਂਦੀ ਹੈ ਕਿ ਆਪਾਂ ਹਰ ਇੱਕ ਪੀੜ੍ਹੀ 'ਚ ਉਸ ਵਾਈਟ ਬਲੈਕ ਐਂਡ ਵਾਈਟ ਨੂੰ ਆਪਾਂ ਯੂਸ ਕਰ ਸਕਦੇ ਹਾਂ ਉਸ ਪਿਚਰ ਨੂੰ ਹੋਰ ਨਿਖਾਰਨ ਲਈ ਅਤੇ ਇੱਕ ਤਾਂ ਇਹ ਡਰਾਮਾ ਕ੍ਰੀਏਟ ਕਰਦੀ ਹੈ ਮੋਡ ਡਮੈਟਿਕ ਬਣਾ ਦਿੰਦੀ ਹੈ ਮਤਲਬ ਜਿਵੇਂ ਆਪਾਂ ਥੋੜ੍ਹੇ ਜਿਵੇਂ ਆਪਾਂ ਕਹੀਏ ਡਾਕ ਟੋਨ ਯੂਸ ਕਰੀਏ ਨਾ ਆਪਾਂ ਫੋਟੋ ਦੇ ਵਿੱਚ ਅਤੇ ਉਹਨੂੰ ਇਹਨੂੰ ਮਤਲਬ ਉਹ ਬਲੈਕ ਐਂਡ ਵਾਈਟ ਫੋਟੋ ਉਹ ਦਰਸਾਉਂਦੀ ਆ ਅਤੇ ਜਿਹੜੀ ਮੋਨੋਕ੍ਰਮਟਿਕ ਹੈ ਉਹਦੇ 'ਚ ਕੀ ਹੈ ਕਿ ਆਪਾਂ ਇੱਕ ਹੀ ਰੰਗ ਦੇ ਜਿਹੜੇ ਵੱਖਰੇ ਵੱਖਰੇ ਉਹ ਹੈਗੇ ਨੇ ਇੱਕ ਹੀ ਜੇ ਆਪਾਂ ਕਹਿ ਲਈਏ ਕਿ ਇੱਕ ਹੀ ਰੰਗ ਦੇ ਵੱਖਰੇ ਵੱਖਰੇ ਸ਼ੇਡ ਨੇ ਆਪਾਂ ਉਹ ਯੂਸ ਕਰਕੇ ਹੋਰ ਉਹ ਫੋਟੋ ਨੂੰ ਹੋਰ ਨਿਖਾਰ ਸਕਦੇ ਹਾਂ ਕਿ ਜਿਹੜੀ ਫੋਟੋ ਹੈ ਉਹਦੇ 'ਚ ਆਪਣੀ ਨਜ਼ਰ ਕਿੱਥੇ ਜਾਏਗੀ ਕਿਸ ਮਤਲਬ ਉਸ ਜਿਹੜੀ ਕਲਰ ਦੇ ਆਪਾਂ ਸ਼ੇਡ ਯੂਸ ਕਰੀਦੇ ਆ ਨਾ ਉਹਦੇ ਉਹਨੂੰ ਕਾਫੀ ਨਿਖਰ ਕੇ ਦਿਖਾਉਂਦੀ ਆ ਜਦੋਂ ਆਪਾਂ ਇਹ ਜਿਹੜੀ ਮੋਨੋਕ੍ਰਮੈਟਿਕ ਚਿੱਤਰ ਨੇ ਇਹ ਕਾਫੀ ਤਰ੍ਹਾਂ ਜਿੱਦਾਂ ਆਪਾਂ ਕਹਿ ਲਈਏ ਕਿ ਐਡਜ ਬਣਾਉਣ 'ਚ ਯੂਸ ਹੁੰਦੀਆਂ ਨੇ ਜਦੋਂ ਆਪਾਂ ਕਿਸੇ ਚੀਜ਼ ਨੂੰ ਪ੍ਰਮੋਟ ਕਰੀਦਾ ਜਿੱਦਾਂ ਆਪਾਂ ਕਿਸੇ ਵੀ ਬੋਟਲ ਨੂੰ ਜਾਂ ਕਿਸੇ ਵੀ ਪ੍ਰੋਡਕਟ ਨੂੰ ਜਦੋਂ ਆਪਾਂ ਪ੍ਰਮੋਟ ਕਰੀਦਾ ਤਾਂ ਆਪਾਂ ਮੋਨੋਕ੍ਰਮੈਟਿਕ ਯੂਸ ਕਰਦੇ ਕਿ ਇੱਕ ਹੀ ਕਲਰ ਦੇ ਵੱਖਰੇ ਵੱਖਰੇ ਜਿਹੜੇ ਅੱਗੇ ਉਹਦੇ ਪਾਰਟਸ ਹੁੰਦੇ ਨੇ ਉਹ ਯੂਸ ਕਰਕੇ ਆਪਾਂ ਉਹ ਚਿੱਤਰ ਬਣਾਈਦਾ ਧੰਨਵਾਦ